ਪਿੱਛੇ ਜਿਹੇ ਨਾ ਇੱਕ ਫ਼ਰਿੱਜ ਲਿੱਤਾ ਸੀਗਾ ਨਵਾਂ ਮੈਂ ਬੜਾ ਵਧੀਆ ਨਿਕਲਿਆ ਪੰਜ ਸੌ ਬੱਤੀ ਲੀਟਰ ਸੈਮਸੰਗ ਦਾ ਹੈਗਾ ਡਬਲ ਡੌਰ ਫ਼ਰਿੱਜ ਅਤੇ ਉਹਦੇ 'ਚ ਉਹਨਾਂ ਨੇ ਨਾ ਬੜੀ ਖਾਸੀਅਤ ਵਾਲੀ ਚੀਜ਼ ਇਹ ਕਿ ਡਿਸਪੈਂਸਰ ਪਾਇਆ ਹੋਇਆ ਫ਼ਰਿੱਜ ਦੇ ਵਿੱਚ ਉਹਦੇ 'ਚ ਉਨ੍ਹਾਂ ਨੇ ਨਾਲ ਉਹ ਸਿਮਪਲ ਡਿਸਪੈਂਸਰ ਹੈ ਵਾਟਰ ਦਾ ਤੁਸੀਂ ਗਲਾਸ ਮੂਹਰੇ ਫਰੰਟ 'ਤੇ ਲਗਾਉਂਦੇ ਹੋ ਪੁਸ਼ ਹੋ ਜਾਂਦਾ ਬਟਨ ਜਾ ਉਹਦਾ ਅਤੇ ਉਹਦੇ 'ਚ ਨਾ ਫਾਲਤੂ ਖਰਚਾ ਨਹੀਂ ਹੈ ਕਿਉਂਕਿ ਆਰ ਓ ਨਹੀਂ ਲਗਾਉਣਾ ਪੈਂਦਾ ਬੈਕ ਸਾਈਡ 'ਤੇ ਉਨ੍ਹਾਂ ਨੇ ਦਰਵਾਜ਼ੇ ਦੇ ਵਿੱਚ ਪਿੱਛੇ ਇੱਕ ਬੋਤਲ ਜੀ ਬਣਾ ਤੀ ਦੋ ਲੀਟਰ ਦੀ ਤੁਸੀਂ ਉਹਦੇ 'ਚ ਆਪਣਾ ਪਾਣੀ ਪਾ ਦਿਉ ਇੰਨਫੈਕਟ ਜੋ ਮਰਜ਼ੀ ਪਾ ਸਕਦੇ ਹਾਂ ਆਪਾਂ ਉਹਦੇ 'ਚ ਅਤੇ ਕਾਫ਼ੀ ਚੰਗਾਂ ਲੱਗਿਆ ਮੈਨੂੰ ਉਹਦਾ ਫ਼ਰਿੱਜ ਦਾ ਹਿਸਾਬ ਕਿਤਾਬ ਸਪੇਸ ਬਹੁਤ ਜ਼ਿਆਦਾ ਸੀਗੀ ਕਿਉਂਕਿ ਪੰਜ ਸੌ ਬੱਤੀ ਲੀਟਰ ਦਾ ਫ਼ਰਿੱਜ ਹੈ ਬਹੁਤ ਅੱਛੀ ਚੋੜਾਈ ਹੈ ਅਪਰੋਕਸ ਤਿੰਨ ਜਾਂ ਚਾਰ ਪਤੀਲੇ ਵੀ ਇੱਕ ਸ਼ੈਲਫ ਦੇ ਉੱਪਰ ਰੱਖੇ ਜਾਂਦੇ ਪੰਜ ਪੰਜ ਲੀਟਰ ਵਾਲੇ ਤਾਂ ਕਾਫ਼ੀ ਅੱਛੀ ਕੁਆਲਟੀ ਲੱਗੀ ਮੈਨੂੰ ਫ਼ਰਿੱਜ ਦੀ ਕੁਲਿੰਗ ਕਾਫ਼ੀ ਵਧੀਆ ਲੱਗੀ